ਅਸੀਂ ਆਪਣੇ ਵਿਹੜੇ ਵਿੱਚ ਪਾਣੀ ਜਾਂ ਕੁਛ ਖਾਣ ਲਈ ਰੱਖ ਕੇ ਪੰਛੀਆਂ ਨੂੰ ਆਕਰਸ਼ਿਤ ਕਰ ਸਕਦੇ ਹਾਂ ਜਾਂ ਆਪਣੀ ਬਾਲਕਨੀ ਵਿੱਚ ਉਹਨਾਂ ਲਈ ਘਰ ਬਣਾ ਸਕਦੇ ਹਾਂ ਜਿਵੇਂ ਕਿ ਪੰਛੀਆਂ ਨੂੰ ਫੁੱਲ ਬਹੁਤ ਪਸੰਦ ਹੁੰਦੇ ਹਨ ਅਸੀਂ ਉਹਨਾਂ ਦੇ ਘਰ ਨੂੰ ਫੁੱਲਾਂ ਨਾਲ ਸਜਾ ਸਕਦੇ ਹਾਂ ਪੰਛੀਆਂ ਨੂੰ ਜ਼ਿਆਦਾ ਸੂਰਜਮੁਖੀ ਦੇ ਫੁੱਲ ਪਸੰਦ ਹੁੰਦੇ ਹਨ ਅਸੀਂ ਉਹ ਲਗਾ ਕੇ ਉਹਨਾਂ ਨੂੰ ਆਕਰਸ਼ਿਤ ਕਰ ਸਕਦੇ ਹਾਂ ਅਸੀਂ ਆਪਣੇ ਘਰ ਦੀ ਛੱਤ ਉੱਤੇ ਜਾਂ ਵਿਹੜੇ ਵਿੱਚ ਗਰਮੀਆਂ ਵਿੱਚ ਜਾਂ ਸਰਦੀਆਂ ਵਿੱਚ ਵੀ ਪਕਸ਼ੀਆਂ ਲਈ ਪਾਣੀ ਜ਼ਰੂਰ ਰੱਖਦੇ ਹਾਂ ਅਤੇ ਗਰਮੀਆਂ ਵਿੱਚ ਤਾਂ ਰੱਖਣਾ ਵੀ ਜ਼ਰੂਰੀ ਹੈ ਕਿਉਂਕਿ ਸਾਨੂੰ ਜਿੰਨੀ ਪਾਣੀ ਦੀ ਜ਼ਰੂਰਤ ਹੁੰਦੀ ਹੈ ਓਨੀ ਹੀ ਪੰਛੀਆਂ ਨੂੰ ਵੀ ਹੁੰਦੀ ਹੈ ਅਤੇ ਉਹਨਾਂ ਲਈ ਅਨਾਜ ਦੇ ਦਾਣੇ ਵੀ ਰੱਖਦੇ ਹਾਂ ਇਹ ਸਭ ਚੀਜ਼ਾਂ ਨਾਲ ਪੰਛੀਆਂ ਨੂੰ ਆਕਰਸ਼ਿਤ ਕਰ ਸਕਦੇ ਹਾਂ